ਪੰਜਾਬੀ ਲੋਕ ਆਪਣੀ ਇੱਕ ਛ ਪਛਾਣ ਅਤੇ ਸੰਬੰਧ ਦੀ ਭਾਵਨਾਵਾਂ ਨੂੰ ਪ੍ਰਗਟ ਕਰ ਲਈ ਆਪਣੀ ਭਾਸ਼ਾ ਦੀ ਵਰਤੋਂ ਬੜੇ ਹੀ ਪਿਆਰ ਦੇ ਤਰੀਕੇ ਨਾਲ ਸੰਬੰਧਿਤ ਕਰਦੇ ਹਨ ਕਿਉਂਕਿ ਸਾਡੇ ਪੰਜਾਬੀ ਲੋਕ ਹੈ ਜੋ ਕਦੋਂ ਵੀ ਕਿਸੇ ਬਾਹਰ ਜਾਂਦੇ ਹਨ ਕਿਸੇ ਦੂਸਰੇ ਮਤਲਬ ਸ਼ਹਿਰ ਵਿੱਚ ਚਲੇ ਜਾਂਦੇ ਹਨ ਤਾਂ ਜੋ ਪੰਜਾਬੀ ਹੈ ਜੋ ਦੂਸਰੇ ਲੋਕ ਹਨ ਦੂਸਰੀ ਕੰਟਰੀ ਵਾਲੇ ਉਹ ਸਮਝ ਜਾਂਦੇ ਹਨ ਕਿ ਇਹ ਮਤਲਬ ਇਹ ਪੰਜਾਬੀ ਹੈ ਕਿਉਂਕਿ ਸਾਡਾ ਇੱਕ ਪੰਜਾਬੀ ਵੱਖਰੀ ਭਾਸ਼ਾ ਹੈ ਜੋ ਕਿ ਅਸੀਂ ਦੂਸਰੀ ਜਗ੍ਹਾ 'ਤੇ ਚਲੇ ਜਾਂਦੇ ਹਾਂ ਰਾਜਸਥਾਨ ਵਗੈਰਾ 'ਚ ਅਤੇ ਜਾਂ ਕ ਕਿੱਥੇ ਅਸੀਂ ਬਾਹਰ ਸਟੇਟ ਵਿੱਚ ਚਲੇ ਜਾਂਦੇ ਹਾਂ ਅਤੇ ਸਾਡੇ ਬੋਲਣ ਦੇ ਲਿਹਾਜੇ ਤੋਂ ਹੀ ਪਤਾ ਚੱਲ ਜਾਂਦਾ ਹੈ ਕਿ ਇਹ ਪੰਜਾਬੀ ਹੈ ਕਿਉਂਕਿ ਕਿਸੇ ਅਸੀਂ ਹਿੰਦੀ ਮਤਲਬ ਹਿੰਦੀ ਕੰਟਰੀ ਵਗੈਰਾ ਲਾ ਲਓ ਜਾਂ ਹਿੰਦੀ ਜਿਸ ਸਟੇਟ ਵਿੱਚ ਜ਼ਿਆਦਾ ਹਿੰਦੀ ਬੋਲੀ ਜਾਂਦੀ ਹੈ ਉੱਥੇ ਚਲੇ ਜਾਂਦੇ ਹਾਂ ਉਹਨਾਂ ਨੂੰ ਦੂਰੋਂ ਹੀ ਪਤਾ ਲੱਗ ਜਾਂਦਾ ਹੈ ਕਿ ਇਹਨਾਂ ਨੂੰ ਮਤਲਬ ਪੰਜਾਬੀ ਜੋ ਪੰਜਾਬੀ ਹੈ ਉਹ ਪ੍ਰੋਪਰ ਹਿੰਦੀ ਨਹੀਂ ਬੋਲ ਸਕਦਾ ਕਿਉਂਕਿ ਸਾਡੇ ਜੋ ਪੰਜਾਬੀ ਭਾਸ਼ਾ ਇਹ ਅਲੱਗ ਹੈ ਅਤੇ ਇਸ ਲਈ ਪੰਜਾਬੀ ਵਾ ਜੋ ਸਾਡੀ ਭਾਸ਼ਾ ਹੈ ਇਸਨੂੰ ਦੂਰੋਂ ਹੀ ਪਹਿਚਾਣ ਜਾਂਦੇ ਹਨ ਕਿਉਂਕਿ ਪੰਜਾਬੀ ਜਿੱਥੇ ਵੀ ਜਾਂਦੇ ਹਨ ਅਤੇ ਰੌਣਕਾਂ ਲਾ ਲੈ ਦਿੰਦੇ ਹਨ ਅਤੇ ਇਹ ਪੰਜਾਬੀ ਹਸਮੁੱਖ ਹੁੰਦੇ ਹਨ ਅਤੇ ਪੰਜਾਬੀਆਂ ਦਾ ਇੱਕ ਮਤਲਬ ਵਕ ਦੂਰੋਂ ਹੀ ਪਤਾ ਚੱਲ ਜਾਂਦਾ ਹੈ ਕਿ ਬੋਲਣ ਤੋਂ ਕਿ ਇਹ ਪੰਜਾਬੀ ਹੈ